ਵੱਖ ਵੱਖ ਤਰ੍ਹਾਂ ਦੇ ਪੰਛੀ ਮਨ ਨੂੰ ਭਾਉਂਦੇ ਹਨ ਪੰਛੀਆਂ ਦਾ ਚਹਿਚਹਾਉਣਾ ਮਨ ਨੂੰ ਚੰਗਾ ਲੱਗਦਾ ਹੈ ਪੰਛੀਆਂ ਦਾ ਅਲੱਗ ਜਿਹਾ ਵਰਤਾਵਾ ਹੁੰਦਾ ਹੈ ਜਿੱਥੇ ਪੌਦੇ ਲੱਗੇ ਹੋਣ ਪੰਛੀ ਖੁਸ਼ ਹੋ ਕੇ ਆਉਂਦੇ ਹਨ ਉਸ ਜਗ੍ਹਾ 'ਤੇ ਉਹਨਾਂ ਦਾ ਰੋਜ਼ ਮਿਲਣਾ ਹੁੰਦਾ ਹੈ ਅਗਰ ਉਸ ਜਗ੍ਹਾ 'ਤੇ ਉਹਨਾਂ ਪੰਛੀਆਂ ਦੇ ਖਾਣ ਪੀਣ ਲਈ ਦਾਣਾ ਜਾਂ ਪਾਣੀ ਰੱਖ ਦਿੱਤਾ ਜਾਵੇ ਤਾਂ ਬਾਕੀ ਪੰਛੀਆਂ ਨੂੰ ਵੀ ਉਹ ਚਹਿਚਹਾਉਂਦੇ ਬੁਲਾਉਂਦੇ ਹਨ ਇਹ ਉਹਨਾਂ ਦਾ ਇੱਕ ਆਪਸੀ ਭਾਈਚਾਰੇ ਦੀ ਨਿਸ਼ਾਨੀ ਕਹਿਲਾਉਂਦੀ ਹੈ ਪੰਛੀ ਆ ਜਿੱਥੇ ਵੀ ਇੱਕ ਜਵਾਰ ਪਹੁੰਚ ਜਾਣ ਖਾਣ ਪੀਣ ਲਈ ਉੱਥੇ ਉਹ ਹਰ ਵਾਰ ਹਰ ਰੋਜ਼ ਪਹੁੰਚਦੇ ਹਨ ਪੰਛੀਆਂ ਨੂੰ ਰੁੱਤਾਂ ਦੀ ਵੱਖਰੀ ਤਰ੍ਹਾਂ ਦੀ ਪਹਿਚਾਨ ਹੁੰਦੀ ਹੈ ਕਿਸ ਤਰ੍ਹਾਂ ਕੋਇਲ ਅੰਬਾਂ ਦੇ ਰੁੱਖ 'ਤੇ ਅੰਬ ਦੇ ਦਰਖ਼ਤ 'ਤੇ ਪਹੁੰਚ ਜਾਂਦੀ ਹੈ ਬਸੰਤ ਪੰਚਮੀ ਵਾਲੇ ਦਿਨ ਕਬੂਤਰ ਆਪਣਾ ਸਿਰ ਪਾਣੀ ਵਿੱਚ ਡੋਬ ਕੇ ਇੱਕ ਤਰ੍ਹਾਂ ਦਾ ਆਪਣਾ ਇਸ਼ਨਾਨ ਕਰਦਾ ਹੈ ਇਹ ਪੰਛੀਆਂ ਦੇ ਵੱਖ ਵੱਖ ਤਰ੍ਹਾਂ ਦੇ ਵਰਤਾਵੇ ਹੀ ਹਨ ਜੋ ਸਾਨੂੰ ਹੈਰਾਨ ਕਰ ਦਿੰਦੇ ਹਨ ਦੂਰ ਦੇਸ਼ਾਂ ਤੋਂ ਬਰਫ ਵਾਲੇ ਏਰੀਆ ਨੂੰ ਛੱਡ ਕੇ ਪੰਛੀ ਇਹ ਕਈ ਜਗ੍ਹਾ ਗਰਮੀਆਂ ਦੀਆਂ ਰੁੱਤਾਂ ਵਿੱਚ ਕਈ ਝੀਲਾਂ 'ਤੇ ਪਹੁੰਚਦੇ ਹਨ ਇਹ ਹੈਰਾਨ ਕਰਨ ਵਾਲੀਆਂ ਹੀ ਗੱਲਾਂ ਹਨ